ਪਸ਼ੂਆਂ ਦੀਆਂ ਬਿਮਾਰੀਆਂ ਇਹ ਆਮ ਗੱਲ ਹੈ ਅੱਜ ਕੱਲ੍ਹ ਪਸ਼ੂਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਹਨ ਜਿਵੇਂ ਕਿ ਮੂੰਹ ਖੁਰ ਮਸਟਾਈਟਸ ਗਲ ਘੋਟੂ ਬੁਖਾਰ ਜੁਕਾਮ ਆਦਿ ਬਹੁਤ ਜ਼ਿਆਦਾ ਪਸ਼ੂ ਬਿਮਾਰੀਆਂ ਲੱਗ ਰਹੀਆਂ ਹਨ ਅਤੇ ਜਿਹਨਾਂ ਨੂੰ ਬਚਾਉਣ ਦੇ ਉਹਨਾਂ ਨੂੰ ਇੰਜੈਕਸ਼ਨ ਟੀਕੇ ਲਗਾਏ ਜਾਂਦੇ ਹਨ ਜਿਵੇਂ ਕਿ ਮਲੋਕਸੀਵੈਰਾ ਐਂਨ ਐਂਨਰੋਫੋਕਸਾਸਿਨ ਓਕਸੀਟੈਟਰਾ ਸਾਈਕਲਿਨ ਦੇ ਇੰਜੈਕਸ਼ਨ ਲਾਏ ਜਾਂਦੇ ਹਨ ਤਾਂ ਕਿ ਉਹ ਬਿਮਾਰੀਆਂ ਤੋਂ ਬਚ ਸਕਣ ਅਤੇ ਆਪਦੇ ਕੱਖ ਕੰਡਾ ਖਾ ਸਕਣ ਭੁੱਖ ਲੱਗਣ ਵਾਸਤੇ ਉਹਨਾਂ ਨੂੰ ਬੈਲਾਮਿਲ ਬੀ ਕੰਪਲੈਕਸ ਵਗੈਰਾ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਦਾ ਲੀਵਰ ਸਹੀ ਰਹੇ ਅਤੇ ਉਹਨਾਂ ਨੂੰ ਭੁੱਖ ਦਾ ਵਾਧਾ ਹੋ ਸਕੇ ਬਿਮਾਰੀਆਂ ਬਹੁਤ ਜ਼ਿਆਦਾ ਪਸ਼ੂਆਂ ਨੂੰ ਲੱਗ ਚੁੱਕੀਆਂ ਹਨ ਜਿਹਨਾਂ ਵਿੱਚ ਬਿਮਾਰੀਆਂ ਬੁਖਾਰ ਦੀਆਂ ਸਰੀਰ ਨੂੰ ਜਕੜਨਾ ਆਦਿ ਬਿਮਾਰੀਆਂ ਬਹੁਤ ਜ਼ਿਆਦਾ ਹੋ ਸਕੀਆਂ ਹਨ ਮੈਂ ਇੱਕ ਡਾਕਟਰ ਹਾਂ ਮੈਂ ਦੱਸਦਾ ਹਾਂ ਜਦੋਂ ਪਸ਼ੂ ਕੋਈ ਬਿਮਾਰ ਹੁੰਦਾ ਹੈ ਤਾਂ ਅਸੀਂ ਜਾਂਦੇ ਹਾਂ ਅੱਜ ਕੱਲ੍ਹ ਦੇਖਦੇ ਹਾਂ ਮੂੰਹ ਖੁਰ ਚਿਚੜੀਆਂ ਦੇ ਰੋਗ ਟਿੱਕ ਫੀਵਰ ਆਦਿ ਬਹੁਤ ਜ਼ਿਆਦਾ ਬਿਮਾਰੀਆਂ ਪਸ਼ੂਆਂ ਨੂੰ ਲੱਗ ਚੁੱਕੀਆਂ ਹਨ ਜਿਹਨਾਂ ਦੀ ਰੋਕਥਾਮ ਲਈ ਅਸੀਂ ਉਹਨਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਦੇਖਦੇ ਹਾਂ ਪਹਿਲਾਂ ਉਹਨਾਂ ਦਾ ਟੈਂਪਰੇਚਰ ਚੈੱਕ ਕਰਦੇ ਹਾਂ ਫਿਰ ਉਹਨਾਂ ਨੂੰ ਦੇਖਦੇ ਹਾਂ ਵੀ ਕਿੰਨਾ ਟੈਂਪਰੇਚਰ ਹੈ ਕੀ ਪਸ਼ੂ ਨੂੰ ਬਿਮਾਰੀ ਹੈ ਟੈਂਪਰੇਚਰ ਵੱਧ ਹੈ ਜਾਂ ਟੈਂਪਰੇਚਰ ਘੱਟ ਹੈ ਉਸ ਤੋਂ ਬਾਅਦ ਉਹਨਾਂ ਦੇ ਇੰਜੈਕਸ਼ਨ ਲਗਾਉਂਦੇ ਹਾਂ ਜਿਵੇਂ ਕਿ ਇੰਜੈਕਸ਼ਨ ਨੋਰਮਲ ਇੰਜੈਕਸ਼ਨ ਲਗਾਉਂਦੇ ਹਾਂ ਜਿਵੇਂ ਕਿ ਮਲੋਕਸੀਵੈਰਾ ਬੁਖਾਰ ਦਰਦ ਵਾਸਤੇ ਐਨਰੋਫਲੋਕਸਾਸਿਨ ਐਂਟੀਬੈਟਿਕ ਗ੍ਰਾਮ ਪੋਜੀਟਿਵ ਗ੍ਰਾਮ ਨੈਗਟਿਵ ਦੇ ਵਾਸਤੇ ਲਗਾਏ ਜਾਂਦੇ ਹਨ ਤਾਂ ਜੋ ਬਿਮਾਰੀ ਨੂੰ ਖਤਮ ਕਰਕੇ ਪਸ਼ੂ ਨੂੰ ਇੱਕ ਨਵਾਂ ਜੀਵਨ ਦਾਨ ਦਿੱਤਾ ਜਾਵੇ ਪਸ਼ੂਆਂ ਵਿੱਚ ਹੋਰ ਬਿਮਾਰੀਆਂ ਜਿਵੇਂ ਕਿ ਥਨੇਲਾ ਰੋਗ ਜਿਸ ਵਿੱਚ ਪਸ਼ੂ ਨੂੰ ਬਹੁਤ ਜ਼ਿਆਦਾ ਦੁੱਧ ਘੱਟਣਾ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਬੁਖਾਰ ਚੜ੍ਹ ਜਾਂਦਾ ਹੈ ਅਤੇ ਪਸ਼ੂ ਨੂੰ ਅਸੀਂ ਇੰਜੈਕਸ਼ਨ ਦਿੰਦੇ ਹਾਂ ਜਿਵੇਂ ਕਿ ਇੰਟਾਸੈਫਟੈਜੋ ਨਾਲ ਮਲੋਕਸੀਵੈਰਾ ਨਾਲ ਇੰਟਾਸੈਫਟੈਜੋ ਦੇ ਨਾਲ ਨਾਲ ਹੋਰ ਬਹੁਤ ਜ਼ਿਆਦਾ ਇੰਜੈਕਸ਼ਨ ਦਿੱਤੇ ਜਾਂਦੇ ਹਨ ਤਾਂ ਜੋ ਪਸ਼ੂਆਂ ਨੂੰ ਦੁੱਧ ਘੱਟਣ ਤੋਂ ਬਚਾਇਆ ਜਾ ਸਕੇ ਅਤੇ ਥਨੇਲਾ ਬਿਮਾਰੀ ਦੇ ਰੋਗਾਂ ਤੋਂ ਮੁਕਤ ਕੀਤਾ ਜਾਵੇ ਬਿਮਾਰੀਆਂ ਨਾਲ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਹੈ ਪਸ਼ੂ ਸੋਹਣਾ ਤੰਦਰੁਸਤ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ ਬਿਮਾਰੀਆਂ ਨੂੰ ਬਚਾਉਣਾ ਹੀ ਸਾਡਾ ਫਰਜ਼ ਹੈ